ਰੇਡੀਓ ਦੀਆਂ ਖ਼ਬਰਾਂ ਸੱਚੀਆਂ ਹੁੰਦੀਆਂ ਨੇ ਪਰ ਬਦਲਦੇ ਸਮੇਂ ਨਾਲ ਰੇਡੀਓ ਦੀ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਗਈ ਹੈ ਗਿਨਵੇਂ ਚੁਣਵੇਂ ਕੋਈ ਲੋਕਾਂ ਕੋਲ ਰੇਡੀਓ ਹੈ ਪਰ ਹੁਣ ਮੋਬਾਇਲ ਦਾ ਯੁੱਗ ਹੈ ਅਤੇ ਮੋਬਾਇਲ ਤਾਂ ਜ਼ਿਆਦਾ ਲੋਕਾਂ ਕੋਲ ਹੈ ਔਰ ਸੋਸ਼ਲ ਮੀਡੀਆ ਵੀ ਹੈ ਕਿਉਂਕਿ ਨਵੀਆਂ ਵਨ ਸੁਵੰਨੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ ਪਰ ਉਹ ਸੱਚੀਆਂ ਵੀ ਹੁੰਦੀਆਂ ਨੇ ਕੁਛ ਅਤੇ ਜ਼ਿਆਦਾਤਰ ਝੂਠੀਆਂ ਇਸ ਕਰਕੇ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਅਖ਼ਬਾਰ ਅਖ਼ਬਾਰ 'ਤੇ ਸਾਰੀ ਖ਼ਬਰ ਜਿਹੜੀ ਜੋ ਵੀ ਹੁੰਦੀ ਹੈ ਇਹ ਸੱਚੀ ਹੁੰਦੀ ਹੈ ਕਿਉਂਕਿ ਇਹਨੂੰ ਸਟਡੀ ਕੀਤਾ ਜਾਂਦਾ ਇਹਦੇ 'ਤੇ ਇੱਕ ਕੋਲਮ ਦੋ ਕੋਲਮ ਮ ਲਿਖੇ ਜਾਂਦੇ ਨੇ ਅਤੇ ਹਰ ਖ਼ਬਰ ਦਾ ਰਿਕਾਰਡ ਹੁੰਦਾ ਹੈ ਇਹ ਇੱਕ ਸੌ ਵੀਹ ਸਾਲ ਦੋ ਸੌ ਸਾਲ ਪੁਰਾਣੀਆਂ ਵੀ ਅਖ਼ਬਾਰਾਂ ਹੈ ਵਾ ਜਿਹਨਾਂ ਦਾ ਰਿਕਾਰਡ ਅੱਜ ਵੀ ਕਢਾਇਆ ਜਾ ਸਕਦਾ ਹੀ ਇਸ ਕਰਕੇ ਅਖ਼ਬਾਰ ਦੀਆਂ ਖ਼ਬਰਾਂ 'ਤੇ ਯਕੀਨ ਵੀ ਕੀਤਾ ਜਾ ਸਕਦਾ ਹੈ ਅਤੇ ਅਖ਼ਬਾਰ ਦੀਆਂ ਖਖ਼ਰਾਂ ਸਹੀ ਵੀ ਹੁੰਦੀਆਂ ਹਨ